ਮੇਰਾ ਕੁਕਿੰਗ ਵਿੱਚ ਸ਼ੁਰੂ ਤੋਂ ਹੀ ਕਾਫ਼ੀ ਰੁਝਾਨ ਸੀ ਮੈਂ ਕੁਕਿੰਗ ਕਲਾਸਾਂ ਔਨਲਾਈਨ ਅਤੇ ਔਫਲਾਈਨ ਦੋਨੋਂ ਮੋਡ ਤੋਂ ਸਿੱਖੀਆਂ ਹਨ ਸਾਡੇ ਨੇੜੇ ਹੀ ਇੱਕ ਵਰਕਸ਼ਾਪ ਹੈ ਜਿਸਦਾ ਨਾਮ ਹੈ ਤੰਦਰੁਸਤ ਵਰਕਸ਼ੋਪ ਇਸ ਵਿੱਚ ਮੈਂ ਕਾਫ਼ੀ ਦੇਰ ਕੁਕਿੰਗ ਦਾ ਕੰਮ ਵੀ ਕੀਤਾ ਹੈ ਅਤੇ ਮੈਂ ਕਾਫ਼ੀ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਹੈ ਅਤੇ ਮੈਂ ਕੁਕਿੰਗ ਕਲਾਸਾਂ ਵਿੱਚੋਂ ਕਾਫ਼ੀ ਅਲੱਗ ਅਲੱਗ ਕਲਚਰ ਦੇ ਫੂਡ ਖਾਣੇ ਬਣਾਉਣੇ ਸਿੱਖੇ ਜਿਸ ਵਿੱਚ ਕੁਝ ਉਦਾਹਰਣ ਨੇ ਜਿਵੇਂ ਕਿ ਚੀਜ਼ ਚਿਲੀ ਚਾਈਨੀਜ਼ ਨੂਡਲਸ ਅਤੇ ਪੈਟੀਜ ਐਂ ਅਤੇ ਹੋਰ ਹੋਰ ਨਵੇਂ ਪ੍ਰਕਾਰ ਦੇ ਖਾਣੇ ਬਣਾਉਣੇ ਸਿੱਖੇ ਸੀ ਅਤੇ ਇਹਨਾਂ ਵਿੱਚ ਮੇਰਾ ਕਾਫ਼ੀ ਰੁਝਾਨ ਬਨ ਬਣਦਾ ਗਿਆ ਹਜੇ ਹੋਰ ਵੀ ਕਈ ਪਦਾਰਥ ਦੇ ਭੋਜਨ ਹਨ ਜੋ ਮੈਂ ਬਣਾਉਣਾ ਸਿੱਖਣਾ ਚਾਹੁੰਦੀ ਹਾਂ ਮੈਂ ਔਨਲਾਈਨ ਆਪਣੀਆਂ ਕੁਕਿੰਗ ਕਲਾਸਿਸ ਲੈ ਰਹੀ ਹਾਂ ਅਤੇ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਤਾਂ ਮੈਂ ਕੁਝ ਨਵੇਂ ਪ੍ਰਕਾਰ ਦਾ ਭੋਜਨ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਮੇਰਾ ਕੁਕਿੰਗ ਵਿੱਚ ਕਾਫ਼ੀ ਜ਼ਿਆਦਾ ਰੁਝਾਨ ਹੈ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮੈਂ ਜੋ ਵੀ ਬਣਾਉਣਾ ਸਿੱਖਾਂ ਉਹ ਹੈਲਥੀ ਹੋਵੇ ਤਦ ਕਿ ਸਾਡੀ ਸਿਹਤ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਅਤੇ ਸਾਰੇ ਉਸ ਨੂੰ ਆਨੰਦ ਨਾਲ ਖਾਣ